ਕੁਝ ਮਸ਼ਹੂਰ ਟਾਸਕ ਯੂਟੀਊਬ ਚੈਨਲ ਇਸ ਪ੍ਰਕਾਰ ਹੈ ਗਰੇਟ ਇੰਡੀਆ ਡਾਂਸਰ ਦਾ ਯੂਟਿਊਬ ਚੈਨਲ ਹੈ ਸੈਟ ਇੰਡੀਆ ਜਿਸ ਜੋ ਬਹੁਤ ਜਿਆਦਾ ਮਸ਼ਹੂਰ ਹੈ ਉਸ ਤੋਂ ਬਾਅਦ ਡਾਂਸਿੰਗ ਹੱਬ ਹੈ ਚੈਨਲ ਯੂਟੀਊਬ ਦਾ ਡਾਂਸਿੰਗ ਵਿਦ ਡਾਕਟਰ ਵਰਨ ਡਾਂਸਿੰਗ ਫੂਲ ਇਹ ਸਾਰੇ ਯੂਟਿਊਬ ਚੈਨਲ ਹਨ ਟੀ ਵੀ ਸ਼ੋ ਡਾਂਸ ਇੰਡੀਆ ਡਾਂਸ ਦਾ ਗਰੇਟ ਇੰਡੀਅਨ ਡਾਂਸਰਜ਼ ਝਲਕ ਦਿਖਲਾ ਜਾ ਇਹ ਸਾਰੇ ਟੀਵੀ ਸ਼ੋਜ਼ ਹਨ ਜੋ ਮੈਂ ਦੇਖੇ ਹੋਏ ਹਨ ਇਹਨਾਂ ਡਾਂਸਾ ਵਿੱਚ ਲੋਕ ਨਾਚ ਦਿਖਾਈ ਦਿੰਦਾ ਹੈ ਕੁਝ ਹੱਦ ਤੱਕ ਪੂਰੀ ਤਰ੍ਹਾਂ ਨੀ ਕਹਿ ਸਕਦੇ ਪਰ ਲੋਕ ਨਾਚ ਇਹਨਾਂ ਵਿੱਚ ਹੁੰਦਾ ਹੈ